ਭਾਰਤੀ ਸਿੱਖਿਆ ਪ੍ਰਣਾਲੀ ਬਾਰੇ ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਹਿਲੇ ਜ਼ਮਾਨੇ 'ਚ ਕੁੜੀਆਂ ਨੂੰ ਸਕੂਲ ਭੇਜਣਾ ਭੇਜਿਆ ਨਹੀਂ ਜਾ ਪੜ੍ਹਨ ਲਈ ਭੇਜਿਆ ਨਹੀਂ ਜਾ ਭੇਜਿਆ ਨਹੀਂ ਜਾਂਦਾ ਸੀ ਜਾਤੀ ਭੇਜਿਆ ਨਹੀਂ ਜਾਂਦਾ ਸੀ ਅਤੇ ਇਹ ਉਹ ਇਹ ਉਹ ਜ਼ਮਾਨਾ ਨਹੀਂ ਹੈ ਇਸ ਇਸ ਜਮਾਨੇ ਵਿਚੋਂ ਕੁੜੀਆਂ ਨੂੰ ਪੜ੍ਹਨ ਦੀ ਛੂਟ ਦਿੱਤੀ ਦਿੱਤਾ ਜਾਵੇ ਅਤੇ ਅਤੇ ਹਰ ਸਕੂਲਾਂ ਵਿੱਚ ਹਰ ਲੈਂਗੁਏਜ ਦੀ ਮੌਜੂਦ ਹੋਣੀ ਚਾਹੀਦੀ ਹੈ ਅਤੇ ਅਤੇ ਜਾਤੀਵਾਦ ਅਤੇ ਜਾਤੀ ਧਰਮ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ ਹੈ ਅਤੇ ਹਰ ਸਾ ਹਰ ਸਟੂਡੈਂਟ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ ਸਾਰੇ ਲੈਂਗੁਏਜ ਨੂੰ ਹਰ ਸਟੂਡੈਂਟ ਨੂੰ ਸਮ ਸਮਝਣਾ ਸਹੀ ਹੈ ਚਾਹੇ ਸਮਝਣਾ ਚਾਹੀਦਾ ਹੈ ਅਤੇ ਕੋਲਜਾਂ ਅਤੇ ਸਕੂਲ 'ਚ ਹਰੇਕ ਲੈਂਗੁਏਜ ਵੀ ਮੌਜੂਦ ਹੋਣੀ ਚਾਹੀਦੀ ਹੈ ਅਤੇ ਅਤੇ ਜਾਤੀ ਭੇਦਭਾਵ ਦੇ ਨਹੀਂ ਕਰਨਾ ਚਾਹੀਦਾ ਹੈ ਸਾਰੇ ਸਿੱਖਿਆ 'ਚ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਸਾਰੇ ਸਕੂਲਾਂ ਨੂੰ ਸਮਾਨ ਸਮਝਣਾ ਚਾਹੀਦਾ ਹੈ